ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਸੁਣਾਓ ਕੀ ਹਾਲ ਚਾਲ ਹੈ ਬਸ ਵ ਵਧੀਆ ਬਸ ਵਧੀਆ ਤੁਸੀਂ ਸੁਣਾਓ ਤੁਹਾਡੇ ਕਿੱਦਾਂ ਗਏ ਹੁਣ ਤਾਂ ਰਿਜ਼ਲਟ ਹੀ ਦੱਸੇਗਾ ਕੀ ਵਾ ਕਿੱਦਾਂ ਦੇ ਗਏ ਔਰ ਹੁਣ ਅੱਜ ਕੱਲ੍ਹ ਐਡਮਿਸ਼ਨ ਅੱਗੇ ਕਿੱਥੇ ਲੈਣੀ ਪਲੱਸ ਟੂ ਤੋਂ ਬਾਅਦ ਹਾਂ ਹਾਂ ਹਾਂ ਸਾਈ ਕਾਲਜ ਮੈਂ ਵੀ ਸੁਣਿਆ

ਅਤੇ ਸਾਈ ਕਾਲਜ ਦੀ ਮੈਂ ਸੁਣਿਆ ਇੱਥੇ ਬੱਸਾਂ ਵੀ ਲੱਗੀ ਦੀਆਂ ਹਾਂ ਮੈਂ ਵੀ ਸੁਣਿਆ ਇੱਥੇ ਡੇਲੀ ਸਾਡੇ ਦੋ ਜਾਂਦੇ ਉਹ ਟੀਚਰ ਹਾਂ ਹਾਂ ਅਤੇ ਬਾਕੀ ਮੈਂ ਆਪਣੇ ਪੇਰੇਂਟਸ ਨਾਲ ਗੱਲ ਕਰ ਕੇ ਦੱਸਾਂਗਾ ਨਾ ਅੱਗੇ ਕਿੱਦਾਂ ਕਰਨਾ

ਹੋਰ ਹਾਂ ਹੁਣ ਰਿਜਲਟ ਜਦੋਂ ਆਏਗਾ ਫਿਰ ਉਸ ਤੋਂ ਬਾਅਦ ਹੀ ਗੱਲ ਹੋਣੀ ਠੀਕ ਆ ਜੀ ਓਕੇ